ਵਿੱਤੀ ਸੁਵਿਧਾਵਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਯੋਗਦਾਨ ਕੀਤਾ ਹੈ ਜਿੱਥੇ ਇਹਨਾਂ ਦੇ ਇਨਸਾਨ ਨੂੰ ਬਹੁਤ ਜ਼ਿਆਦਾ ਲਾਭ ਹਨ ਉਹਦੇ ਨਾਲ ਨਾਲ ਕੁਛ ਹਾਣੀਆਂ ਵੀ ਹਨ ਇਹਨਾਂ ਦੇ ਆਉਣ ਦੇ ਨਾਲ ਅਸੀਂ ਜਿਹੜੇ ਖਾਤੇ 'ਚੋਂ ਜਦੋਂ ਪੈਸੇ ਕਢਵਾਉਂਦੇ ਸੀਗੇ ਤਾਂ ਆਪਣੀ ਗਿਣ ਕੇ ਅਸੀਂ ਉਸ ਹਿਸਾਬ ਨਾਲ ਖਰਚਾ ਕਰਦੇ ਸੀ ਪਰ ਆਹ ਜਿਹੜੇ ਕਾਰਡ ਸਾਡੇ ਬੱਚਿਆਂ ਦੇ ਹੱਥਾਂ 'ਚ ਸਾਡੇ ਹੱਥਾਂ 'ਚ ਫੜਾ ਦਿੱਤੇ ਗਏ ਹਨ ਉਹਦੇ ਨਾਲ ਸਭ ਤੋਂ ਵੱਡੀ ਮੁਸੀਬਤ ਕੀ ਆ ਗਈ ਹੈ ਕਿ ਹੁਣ ਖਰਚੇ ਜ਼ਿਆਦਾ ਵੱਧ ਗਏ ਹਨ ਅਤੇ ਆਮਦਨ ਦੇ ਸਾਰੇ ਰਸਤੇ ਘੱਟ ਗਏ ਹਨ ਇਨਸਾਨ ਨੂੰ ਅਲੱਗ ਅਲੱਗ ਸਕੀਮਾਂ ਦਿੰਦੇ ਦਿੱਤੀਆਂ ਜਾਂਦੀਆਂ ਹਨ ਅ ਦਿੱਤੀਆਂ ਜਾਂਦੀਆਂ ਹਨ ਜਿਹਦੇ ਵਿੱਚ ਹਰ ਥਾਂ ਸਾਨੂੰ ਇਹ ਪਤਾ ਕਿ ਖਰਚਾ ਕਿੱਦਾਂ ਕਰਨਾ ਹੈ ਪਰ ਪੈਸਾ ਆਉਣਾ ਕਿੱਥੋਂ ਹੈ ਇਹਦੇ ਉੱਤੇ ਕੋਈ ਨਹੀਂ ਸੋਚਦਾ ਦਿਨ ਭਰ ਦਿਨ ਹਰ ਬੰਦੇ ਉੱਤੇ ਇਹ ਵਿੱਤੀ ਚੁਣੌਤੀਆਂ ਵੱਧਦੀਆਂ ਜਾ ਰਹੀਆਂ ਹਨ ਅਸ ਅੱਜ ਦੇ ਬੱਚੇ ਆਉਣ ਵਾਲਾ ਭਵਿੱਖ ਜੋ ਹੈ ਉਹਦੇ ਵਿੱਚ ਇਨਸਾਨ ਸੋਚਦਾ ਨਹੀਂ ਹੈ ਕਿ ਕਿੱਥੋਂ ਆਉਣਾ ਪੈਸਾ ਕਿੱਦਾਂ ਲਗਾਉਣਾ ਹੈ ਕਿੱਥੇ ਕਿੱਥੇ ਜਾਣਾ ਹੈ ਉਹ ਸਾਡਾ ਪਹਿਲਾਂ ਹੀ ਤੈਅ ਹੁੰਦਾ ਹੈ